ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਕਿਤਾਬਾਂ ਪੜ੍ਹੀਆਂ ਹਨ ਅਤੇ ਮੇਰੀਆਂ ਇਹ ਪਸੰਦੀਦਾ ਸ਼ੈਲੀਆਂ ਹਨ ਅਤੇ ਮੈਂ ਹੁਣੇ ਇੱਕ ਹਾਲ ਹੀ ਦੇ ਵਿੱਚ ਮੈਂ ਕਿਤਾਬ ਪੜ੍ਹੀ ਹੈ ਜਿਸ ਦਾ ਨਾਮ ਸਮਾਜਿਕ ਰਿਸ਼ਤੇ ਸੀ ਅਤੇ ਸਮਾਜਿਕ ਰਿਸ਼ਤਿਆਂ ਦੇ ਵਿੱਚ ਸਾਡੇ ਆ ਜਾਂਦੇ ਨੇ ਮਾਤਾ ਪਿਤਾ ਭੈਣ ਭਰਾ ਮਾਮੇ ਮਾਸੀਆਂ ਅਤੇ ਉਹ ਜਿਹੜੇ ਸਾਡੇ ਸਮਾਜਿਕ ਰਿਸ਼ਤੇ ਐਂ ਉਨ੍ਹਾਂ ਦੇ ਵਿੱਚ ਮੈਂ ਇਹ ਸਭ ਕੁਛ ਪੜ੍ਹਿਆ ਕਿ ਵਿਅਕਤੀ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੁੰਦਾ ਆ ਵਿਅਕਤੀ ਤੋਂ ਬਿਨਾਂ ਇਹ ਰਿਸ਼ਤੇ ਸਥਾਪਿਤ ਨਹੀਂ ਹੋ ਸਕਦੇ ਅਤੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਉਸ ਦੇ ਮਾਤਾ ਪਿਤਾ ਦਾ ਬਹੁਤ ਹੀ ਵੱਡਾ ਯੋਗਦਾਨ ਹੁੰਦਾ ਹੈ ਉਸ ਤੋਂ ਬਿਨਾਂ ਮਾਤਾ ਪਿਤਾ ਦੇ ਲਈ ਵੀ ਆਪਣੇ ਬੱਚੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੇ ਨੇ ਅਤੇ ਫਿਰ ਉਨ੍ਹਾਂ ਦੇ ਜੀਵਨ ਦੇ ਵਿੱਚ ਅੱਗੇ ਵਧਣ ਦੇ ਲਈ ਉਤਸ਼ਾਹਿਤ ਕਰਦੇ ਹਨ ਉਹ ਕਿਤਾਬ ਦੇ ਵਿੱਚ ਮੈਂ ਸਮਾਜਿਕ ਰਿਸ਼ਤਿਆਂ ਬਾਰੇ ਪੜ੍ਹਿਆ